ਮੈਂ ਸ਼ੀਤਲ ਕੁਮਾਰੀ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਨੂੰ ਕਈ ਚੀਜ਼ਾਂ ਦਾ ਸ਼ੌਕ ਹੈ ਪਰ ਮੈਂ ਜੇ ਗੱਲ ਕਰਾਂ ਬੂਟੇ ਪੇੜ ਪੌਦਿਆਂ ਆਦਿ ਲਗਾਉਣ ਦਾ ਮੈਨੂੰ ਕਾਫ਼ੀ ਸ਼ੌਕ ਹੈ ਇਹ ਇਹ ਸ਼ੌਕ ਮੈਨੂੰ ਬਚਪਨ ਤੋਂ ਹੈ ਬਚਪਨ ਵਿੱਚ ਵੀ ਮੈਂ ਕਿੰਨੇ ਸਾਰੇ ਪੌਦੇ ਆਪਣੇ ਘਰ ਉਗਾਏ ਸੀ ਅਲੱਗ ਅਲੱਗ ਤਰ੍ਹਾਂ ਦੇ ਪੌਦੇ ਉਗਾਉਣ ਦਾ ਮੈਨੂੰ ਬਹੁਤ ਸ਼ੌਕ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਨਰਸਰੀ ਵਿੱਚ ਜਾ ਕੇ ਵੱਖ ਵੱਖ ਪ੍ਰਜਾਤੀਆਂ ਦੇ ਪੌਦੇ ਵੇਖਣ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਕਰਨ ਲਈ ਕਾਫ਼ੀ ਸ਼ੌਕ ਹੈ ਇਸਦੇ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਆਪਣੇ ਘਰ ਵਿੱਚ ਇਹ ਕਈ ਤਰ੍ਹਾਂ ਦੇ ਪੌਦੇ ਉਗਾਏ ਹੋਏ ਹਨ ਜਿਵੇਂ ਕਿ ਗੁਲਾਬ ਤੁਲਸੀ ਪੌਦਾ ਜਿੱਦਾਂ ਸੂਰਜਮੁਖੀ ਦਾ ਫੁੱਲ ਗੇਂਦੇ ਦਾ ਪੌਦਾ ਆਦਿ ਦੇ ਇਸਨੂੰ ਲਗਾਉਣ ਲਈ ਸਾਨੂੰ ਕਈ ਚੀਜ਼ਾਂ ਦਾ ਪਾਲਣ ਕਰਨਾ ਪੈਂਦਾ ਹੈ ਜਿਵੇਂ ਕਿ ਪੌਦੇ ਉਗਾਉਣ ਲਈ ਇੱਕ ਚੰਗੀ ਮਿੱਟੀ ਪੈਦਾ ਹੈ ਜਿਵੇਂ ਕਿ ਪੌਦੇ ਉਗਾਉਣ ਲਈ ਚੰਗੀ ਮਿੱਟੀ ਦਾ ਪ੍ਰਯੋਗ ਕਰਨਾ ਪੈਂਦਾ ਹੈ ਨਾਲ ਇਸ ਨੂੰ ਪੌਦੇ ਦੇ ਅਨੁਸਾਰ ਉਸਨੂੰ ਚੰਗੀ ਧੁੱਪ ਅਤੇ ਉਸਦੇ ਹਿਸਾਬ ਨਾਲ ਪਾਣੀ ਆਦਿ ਮਿਲਣਾ ਚਾਹੀਦਾ ਹੈ ਇਸ ਵਾਸਤੇ ਮਿੱਟੀ ਦਾ ਉਪਯੋਗ ਬਹੁਤ ਜ਼ਰੂਰੀ ਕਿ ਪੌਦੇ ਨੂੰ ਵਧਣ ਵਿੱਚ ਬਹੁਤ ਸਹਾਇਤਾ ਦਿੰਦਾ ਅਤੇ ਪ ਪੌਦੇ ਦੀ ਜੜ੍ਹਾਂ ਨੂੰ ਤਾਕਤਵਰ ਬਣਾਉਂਦਾ ਹੈ ਇਸ ਦੀ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ ਜਿਸਨੂੰ ਅਸੀਂ ਗਿੱਲੀ ਮਿੱਟੀ ਵੀ ਕਹਿੰਦੇ ਹਾਂ ਇਹ ਮਿੱਟੀ ਦਾ ਬਹੁਤ ਫਾਇਦਾ ਹੈ ਇਹ ਪੌਦਿਆਂ ਨੂੰ ਜਦੋਂ ਮੈਂ ਪੌਦੇ ਉਗਾਉਂਦੀ ਹਾਂ ਜ਼ਿਆਦਾਤਰ ਮੈਂ ਮਿੱਟੀ ਨਰਸਰੀ ਵਿੱਚੋਂ ਲੈ ਕੇ ਆਉਂਦੀ ਹਾਂ ਧੰਨਵਾਦ ਜੀ